ਸਮਾਚਾਰ ਪੱਤਰ ਅਤੇ ਮੀਡੀਆ ਸਾਡੇ ਜੀਵਨ ਵਿੱਚ ਆਪਸੀ ਸੋਚ ਅਤੇ ਵਿਚਾਰਾਂ ਨੂੰ ਹੋਰ ਚਮਕਾਉਣ ਵਾਸਤੇ ਬੜੇ ਸਹਾਇਕ ਹਨ ਇਨ੍ਹਾਂ ਨਾਲ ਸਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ ਅਤੇ ਸਾਡੀ ਸੋਚ ਤਿੱਖੀ ਹੁੰਦੀ ਜਾਂਦੀ ਹੈ ਰੋਜ਼ਾਨਾ ਦੀਆਂ ਸਮਾਜਿਕ ਘਟਨਾਵਾਂ ਤੋਂ ਅਪਡੇਟ ਰਹਿਣ ਨਾਲ ਆਪਾਂ ਸਮਾਜ ਵਿੱਚ ਹੋ ਰਹੇ ਬਦਲਾਵ ਤੋਂ ਜਾਣੂ ਰਹਿ ਸਕਦੇ ਹਾਂ ਅਤੇ ਸਮਾਜ ਵਿੱਚ ਹੋ ਰਹੇ ਅਨਿਆਂ ਦੇ ਖਿਲਾਫ ਅਵਾਜ ਚੁੱਕ ਸਕਦੇ ਹਾਂ